ਮੇਰਾ ਨਾਮ ਅਮਰਦੀਪ ਕੌਰ ਹੈ ਮੇਰੀ ਆਯੂ ਤੀਹ ਸਾਲ ਹੈ ਅਤੇ ਮੇਰਾ ਜਿਹੜਾ ਜਨਮ ਹੈ ਉਹ ਅੰਮ੍ਰਿਤਸਰ ਪੰਜਾਬ ਦਾ ਹੈ ਅਤੇ ਮੇਰਾ ਸਾਰਾ ਪਾਲਣ ਪੋਸ਼ਣ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੀ ਹੋਇਆ ਮੈਂ ਆਪਣੀ ਸਾਰੀ ਸਿੱਖਿਆ ਪ੍ਰਾਪਤ ਵੀ ਜਿਹੜੀ ਕੀਤੀ ਆ ਉਹ ਅੰਮ੍ਰਿਤਸਰ ਦੇ ਵਿੱਚ ਹੀ ਕੀਤ ਰਹਿ ਕੇ ਕੀਤੀ ਹੈ ਅਤੇ ਟੈਨ ਮੈਂ ਜਿਹੜਾ ਟੈਂਥ ਪਲੱਸ ਟੂ ਕੀਤੀ ਹੋਈ ਹੈ ਅਤੇ ਉਸ ਤੋਂ ਬਾਅਦ ਜਿਹੜੀ ਗ੍ਰੈਜੂਏਸ਼ਨ ਹੈ ਉਹ ਮੈਂ ਬੀ ਸੀ ਏ ਦੇ ਵਿੱਚ ਕੀਤੀ ਹੋਈ ਹੈ ਅਤੇ ਮੇਰੀ ਜਿਹੜੀ ਹੋਬੀ ਹੈ ਉਹ ਮੈਨੂੰ ਖਾਣਾ ਬਣਾਉਣਾ ਅਤੇ ਸਿਲਾਈ ਕਢਾਈ ਕਰਨਾ ਕਾਫੀ ਪਸੰਦ ਹੈ ਅਤੇ ਜਦੋਂ ਮੈਂ ਸਵੇਰੇ ਉੱਠਦੀ ਹਾਂ ਤਾਂ ਉਸ 'ਤੇ ਮੈਨੂੰ ਐਕਸਰਸਾਈਜ਼ ਕਰਨਾ ਹਲਕਾ ਫੁਲਕਾ ਵਿਆਮ ਕਰਨਾ ਅੱਛਾ ਲੱਗਦਾ ਉਸਦੇ ਨਾਲ ਸਾਰੇ ਦਿਨ ਸਰੀਰ ਦੇ ਵਿੱਚ ਚੁਸਤੀ ਫੁਰਤੀ ਬਣੀ ਰਹਿੰਦੀ ਹੈ ਅਤੇ ਜਿਹੜਾ ਮੇਰਾ ਵਿਹਲਾ ਸਮੇਂ ਹੁੰਦਾ ਹੈ ਉਹਦੇ ਵਿੱਚ ਮੈਨੂੰ ਕਿਤਾਬਾਂ ਪੜ੍ਹਨੀਆਂ ਪਸੰਦ ਆ ਜਿਨ੍ਹਾਂ ਤੋਂ ਮੈਨੂੰ ਕੁਛ ਗਿਆਨ ਪ੍ਰਾਪਤੀ ਹੋ ਸਕੇ ਅਤੇ ਮੈਂ ਸ਼ਾਮ ਦੇ ਸਮੇਂ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾਉਂਦੀ ਹਾਂ ਕਿਉਂਕਿ ਮੈਨੂੰ ਟਿਊਸ਼ਨਾਂ ਪੜ੍ਹਾਉਣਾ ਅੱਛਾ ਲੱਗਦਾ ਹੈ ਅਤੇ ਉਸ ਅਤੇ ਮੈਂ ਹੁਣ ਜੋਬ ਦੇ ਵਾਸਤੇ ਐਂਟਰੈਂਸ ਇਗਜ਼ਾਮ ਦੀ ਤਿਆਰੀ ਕਰ ਰਹੀ ਹਾਂ ਤਾਂ ਕਿ ਮੈਂ ਇੱਕ ਜੋਬ ਲੈ ਸਕਾਂ ਅਤੇ ਫਰੀ ਟਾਈਮ ਦੇ ਵਿੱਚ ਜਦੋਂ ਮੈਂ ਹੁੰਦੀ ਹਾਂ ਤਾਂ ਆਪਣੇ ਮਾਤਾ ਜੀ ਨਾਲ ਘਰ ਦੇ ਕੰਮਾਂ ਵਿੱਚ ਵੀ ਹੈਲਪ ਕਰਾਉਂਦੀ ਹਾਂ